ਮੈਂ ਪਹਿਲੀ ਵਾਰ ਤੈਰਾਕੀ ਆਪਣੇ ਦੋਸਤ ਨਾਲ ਪੂਲ ਵਿੱਚ ਗਿਆ ਸੀ ਉੱਦੋਂ ਸਿੱਖੀ ਸੀ ਉਸ ਨੇ ਮੈਨੂੰ ਪੂਲ ਵਿੱਚ ਵੜ ਕੇ ਸ਼ੁਰੂਆਤੀ ਤਰੀਕੇ ਨਾਲ ਤੈਰਾਕੀ ਕਰਨੀ ਸਿਖਾਈ ਮੈਂ ਤੈਰਾਕੀ ਵਿੱਚ ਪਹਿਲਾਂ ਬਹੁਤ ਹੀ ਜ਼ਿਆਦਾ ਹੌਲੀ ਸੀ ਅਤੇ ਕਾਫੀ ਡਰਦਾ ਸੀ ਕਿਉਂਕਿ ਪਾਣੀ ਤੋਂ ਮੈਨੂੰ ਡਰ ਲੱਗਦਾ ਸੀ ਕਿ ਕਿਤੇ ਡੁੱਬ ਹੀ ਨਾ ਜਾਵਾਂ ਉਸਨੇ ਮੈਨੂੰ ਸਮਝਾਇਆ ਕਿ ਤੈਰਾਕੀ ਇੰਨੀ ਔਖੀ ਵੀ ਨਹੀਂ ਹੈ ਉਸਨੇ ਮੈਨੂੰ ਕਾਫੀ ਸਟਰੋਕਾਂ ਬਾਰੇ ਦੱਸਿਆ ਜਿਵੇਂ ਕਿ ਫਰੀ ਸਟਾਈਲ ਜਿਸ ਵਿੱਚ ਉਸਨੇ ਮੈਨੂੰ ਸਿੱਧਾ ਸਿੱਧਾ ਤੈਰਾਕੀ ਸਿਖਾਈ ਉਸ ਵਿੱਚ ਅਸਾਂ ਅਸੀਂ ਸਿੱਧਾ ਹੀ ਤੈਰਾਕੀ ਸਿੱਖਦੇ ਹਾਂ ਉਸ ਤੋਂ ਬਾਅਦ ਉਸਨੇ ਬੈਕ ਸਟਰੋਕ ਬਾਰੇ ਦੱਸਿਆ ਜਿਸ ਵਿੱਚ ਅਸਾਂ ਨੂੰ ਪਿੱਠ ਅਨੁਸਾਰ ਤੈਰਨਾ ਪੈਂਦਾ ਹੈ ਅਤੇ ਇਸ ਤੋਂ ਬਾਅਦ ਉਸਨੇ ਇੱਕ ਹੋਰ ਤਰੀਕਾ ਬਟਰਫਲਾਈ ਤਿੱਤਲੀ ਵਾਂਗ ਜਿਸ ਵਿੱਚ ਤਿੱਤਲੀ ਵਾਂਗ ਖੰਭ ਮਾਰਨੇ ਹੁੰਦੇ ਹਨ